ਜੀ ਮੈਂ ਉਸ ਵਿਅਕਤੀ ਨੂੰ ਬਹੁਤ ਸਾਰੀ ਸਲਾਹ ਦੇਣਾ ਚਾਹਵਾਂਗੀ ਜਿਹੜਾ ਪਹਿਲੀ ਵਾਰ ਭੰਗੜਾ ਕਰ ਰਿਹਾ ਕਿਉਂਕਿ ਮੈਂ ਆਪਣੇ ਸਕੂਲ ਟਾਈਮ 'ਤੇ ਬਹੁਤ ਵਾਰ ਭੰਗੜਾ ਕੀਤਾ ਹੈ ਅਤੇ ਮੈਂ ਉਹ ਗੱਲਾਂ ਜ਼ਰੂਰ ਉਹਨਾਂ ਨੂੰ ਦੱਸਣਾ ਚਾਹਵਾਂਗੀ ਜਿਹੜੀਆਂ ਗੱਲਾਂ ਮਤਲਬ ਕਿ ਮੈਨੂੰ ਪਹਿਲੀ ਵਾਰ ਭੰਗੜਾ ਕਰਨ ਲਈ ਦੱਸੀਆਂ ਗਈਆਂ ਸਨ ਮੇਰੇ ਟੀਚਰ ਦੁਆਰਾ ਮੈਨੂੰ ਦੱਸੀਆਂ ਗਈਆਂ ਸਨ ਉਹ ਗੱਲਾਂ ਮੈਂ ਉਸ ਨੂੰ ਜ਼ਰੂਰ ਦੱਸਣਾ ਚਾਹਵਾਂਗੀ ਪਹਿਲੀ ਵਾਰ ਤਾਂ ਆਪਣੇ ਸਰੀਰ ਦਾ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ ਭੰਗੜਾ ਕਰਨ ਲਈ ਕਿਉਂਕਿ ਭੰਗੜਾ ਇੱਕ ਹੈਵੀ ਐਕਸਰਸਾਈਜ਼ ਦੇ ਤੌਰ 'ਤੇ ਕੀਤਾ ਜਾਂਦਾ ਹੈ ਕਿਉਂਕਿ ਭੰਗੜੇ ਲਈ ਸਰੀਰ ਦਾ ਬਹੁਤ ਹੀ ਜ਼ੋਰ ਲੱਗਦਾ ਹੈ ਅਤੇ ਜੋਸ਼ ਜੋਸ਼ੀਲਾਪਨ ਵਾਲਾ ਲੋਕ ਨਾਚ ਹੈ ਇਸ ਕਰਕੇ ਇਸਨੂੰ ਨੱਚਣ ਲਈ ਜਾਂ ਭੰਗੜਾ ਪਾਉਣ ਲਈ ਆਪਾਂ ਨੂੰ ਬਹੁਤ ਜ਼ੋਸ਼ ਦੀ ਜ਼ਰੂਰਤ ਹੈ ਇਸ ਕਰਕੇ ਆਪਣੇ ਸਰੀਰ ਦੇ ਮਤਲਬ ਕਿ ਸਾਰੇ ਮਾਸਪੇਸ਼ੀਆਂ ਦਾ ਜ਼ੋਰ ਲੱਗਦਾ ਹੈ ਐ ਆਪਣੀਆਂ ਲੱਤਾਂ ਬਾਹਾਂ ਇਹਨਾਂ ਦਾ ਖਿਚਾਵ ਹੁੰਦਾ ਹੈ ਇਹ ਤਾਂ ਕਰਕੇ ਆਪਾਂ ਨੂੰ ਆ ਪਹਿਲਾਂ ਭੰਗੜਾ ਕਰਨ ਤੋਂ ਪਹਿਲਾਂ ਆਪਣੇ ਸਰੀਰ ਨੂੰ ਗਰਮਾ ਲੈਣਾ ਚਾਹੀਦਾ ਹੈ ਤਾਂ ਕਿ ਆਪਣੇ ਸਰੀਰ ਜਿਹੜਾ ਭੰਗੜਾ ਕਰਨ ਲਈ ਮਜਬੂਤ ਹੋ ਜਾਵੇ ਤਿਆਰ ਹੋ ਜਾਵੇ ਜੇਕਰ ਆਪਣੀ ਸਰੀਰ ਵਿੱਚ ਗਰਮੀ ਆਵੇਗੀ ਤਾਂ ਆ ਹੋਰ ਭੰਗੜਾ ਕਰਨ ਲਈ ਬਹੁਤ ਹੀ ਆਸਾਨ ਹੋ ਜਾਵੇਗਾ ਸੋ ਪਹਿਲਾਂ ਤਾਂ ਆਪਾਂ ਨੂੰ ਭੰਗੜਾ ਕਿਸੇ ਟੀਚਰ ਦੀ ਹੈਲਪ ਨਾਲ ਹੀ ਕਰਨਾ ਚਾਹੀਦਾ ਤਾਂ ਕਿ ਆਪਾਂ ਨੂੰ ਭੰਗੜੇ ਕਰਨ ਲੱਗੇ ਜੋ ਵੀ ਪਰੇਸ਼ਾਨੀ ਆਵੇ ਉਹ ਆਪਾਂ ਆਪਣੇ ਟੀਚਰ ਨੂੰ ਦੱਸ ਸਕੀਏ ਅਤੇ ਭੰਗੜਾ ਕਰਨ ਲਈ ਪਹਿਲਾਂ ਮਤਲਬ ਮੈਂ ਸਕੂਲ ਵਿੱਚ ਬਹੁਤ ਵਾਰ ਕੀਤਾ ਹੋਇਆ ਭੰਗੜਾ ਅਤੇ ਭੰਗੜਾ ਕਰਨ ਲਈ ਮਤਲਬ ਕਿ ਮਨ 'ਚ ਜੋਸ਼ ਹੋਣਾ ਚਾਹੀਦਾ ਸਰੀਰ ਵਿੱਚ ਜੋਸ਼ ਹੋਣਾ ਚਾਹੀਦਾ ਤਾਂ ਕਿ ਆਪਾਂ ਨੂੰ ਭੰਗੜਾ ਕਰਨ ਲਈ ਇਹ ਸੁਸਤੀ ਜਿਹੀ ਨਾ ਆਵੇ ਸੋ ਆਪਣੇ ਟੀਚਰ ਦੀ ਹੈਲਪ ਲੈ ਲੈਣੀ ਚਾਹੀਦੀ ਹੈ ਤਾਂ ਕਿ ਉਹ ਆਪਾਂ ਨੂੰ ਗਾਈਡ ਕਰ ਸਕਣ ਵੀ ਭੰਗੜਾ ਕਰਨ ਲਈ ਆਪਾਂ ਨੂੰ ਕਿਸ ਕਿਸ ਚੀਜ਼ ਦੀ ਵਰਤੋਂ ਹੋਵੇਗੀ ਅਤੇ ਆਪਣਾ ਕਿਹੜਾ ਕਿਹੜਾ ਪਾਰਟ ਜਿਆਦਾ ਖਿਚਾਵ ਵਿੱਚ ਆਵੇਗਾ ਅਤੇ ਜੇਕਰ ਭੰਗੜਾ ਕਰਨ ਲਈ ਆਪਣੇ ਕਈ ਵਾਰ ਹੋ ਜਾਂਦਾ ਵੀ ਆਪਣੇ ਪੈਰਾਂ 'ਚ ਖੱਲੀਆਂ ਪੈ ਜਾਂਦੀਆਂ ਕਿਉਂਕਿ ਭੰਗੜਾ ਬਹੁਤ ਹੀ ਜੋਸ਼ ਵਾਲਾ ਨਾਚ ਹੈ ਤਾਂ ਆਪਾਂ ਨੂੰ ਗਰਮ ਪਾਣੀ ਦਾ ਉਹ ਕਰ ਲੈਣਾ ਚਾਹੀਦਾ ਹੈ ਸੋ ਤਾਂ ਕਰਕੇ ਆਪਣੀ ਖੱਲੀ